ਪੰਜਾਬੀ ਪੱਗ ਜੋ ਹੈ ਇਹ ਸਾਡੇ ਪੰਜਾਬੀਆਂ ਦਾ ਸ਼ਿੰਗਾਰ ਹੈ ਪੰਜਾਬੀ ਪੱਗ ਸਾਨੂੰ ਜਦੋਂ ਪਿੰਡ ਵਿੱਚ ਅਸੀਂ ਗੁਰੂ ਘਰ ਵਗੈਰਾ ਜਾਂਦੇ ਹਾਂ ਉਸ ਟਾਈਮ ਅਸੀਂ ਪੱਗ ਬੰਨ੍ਹ ਕੇ ਜਾਂਦੇ ਹਾਂ ਕਿਉਂਕਿ ਨੰਗੇ ਸਿਰ ਨਹੀਂ ਜਾ ਸਕਦੇ ਇਸ ਤੋਂ ਇਲਾਵਾ ਅਸੀਂ ਪੱਗ ਆਪਣੇ ਘਰਾਂ ਵਿੱਚ ਜਦੋਂ ਪਾਠ ਵਗੈਰਾ ਰਖਵਾਉਂਦੇ ਹਾਂ ਉਸ ਟਾਈਮ ਵੀ ਅਸੀਂ ਪੱਗ ਬੰਨ੍ਹ ਲੈਂਦੇ ਹਾਂ ਮੈਰਿਜ ਵਗੈਰਾ 'ਤੇ ਜਾਂਦੇ ਹਾਂ ਜਾਂ ਅਸੀਂ ਮੈਰਿਜ ਵੇਲੇ ਕਿਉਂਕਿ ਸ਼ੇਰਵਾਨੀ ਵਗੈਰਾ ਪਾਉਂਦੇ ਹਾਂ ਉਦੋਂ ਵੀ ਅਸੀਂ ਪੱਗ ਬੰਨ੍ਹਦੇ ਹਾਂ ਪੱਗ ਬੰਨ੍ਹਣ ਦੇ ਕਾਫੀ ਤਰੀਕੇ ਹਨ ਅਤੇ ਅਲੱਗ ਅਲੱਗ ਤਰੀਕਿਆਂ ਨਾਲ ਬੰਨ੍ਹੀ ਜਾਂਦੀ ਹੈ ਤਾਂ ਪੱਗ ਬੰਨ੍ਹਣਾ ਸਿਰ ਢੱਕਣਾ ਸਾਡੇ ਪੰਜਾਬੀਆਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਵਿੱਚ ਹੀ ਪੰਜਾਬੀ ਹੈ ਜੋ ਪੱਗ ਬੰਨ੍ਹਦੇ ਹਨ ਅਤੇ ਫਿਰ ਪੱਗ ਬੰਨ੍ਹਣਾ ਚਿੱਟਾ ਪਜਾਮਾ ਕੁੜਤਾ ਪਾਉਣਾ ਅਤੇ ਪੈਰੀ ਜੁੱਤੀ ਪਾਉਣੀ ਪੱਗ ਤੁਰਲੇ ਵਾਲੀ ਪੱਗ ਵੀ ਬਹੁਤ ਬੰਨ੍ਹਣ ਦੇ ਸ਼ੌਕੀਨ ਹਨ ਅੱਜ ਕੱਲ ਜ਼ਿਆਦਾਤਰ ਲੋਕ ਜੋ ਪੰਜਾਬੀ ਆ ਉਹ ਪੱਗ ਬੰਨ੍ਹਦੇ ਹੀ ਹਨ